ਹਾਂਜੀ ਵੀਰ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰ ਤੁਸੀਂ ਕਾਰ ਬਜ਼ਾਰ ਤੋਂ ਬੋਲਦੇ ਹਾਂ ਵੀਰ ਦਿੱਲੀ ਨੰਬਰ ਗੱਡੀਆਂ ਦਾ ਪਤਾ ਕਰਨਾ ਤਾ ਜੀ ਆਪਣੇ ਪਾ ਕਿਹੜੇ ਕਿਹੜੇ ਮੋਡਲ ਹੈ ਜੀ ਆਪਣੇ ਪਾ ਸਕਾਰਪੀਓ ਹੋਵੇਗੀ ਸੋਲ੍ਹਾਂ ਮੋਡਲ ਸਕਾਰਪੀਓ ਲੇ ਕਿੰਨੀ ਕੁ ਚੱਲੀ ਹੋਈ ਹੈ ਜੀ ਉਹ ਅੱਛਾ ਜੀ ਠੀਕ ਹੈ ਜੀ ਅਤੇ ਇਹਦਾ ਪ੍ਰਾਈਜ਼ ਕਿੰਨਾਂ ਸੱਤ ਛੇ ਕ ਠੀਕ ਹੈ ਵੀਰ ਅਤੇ ਹੋਰ ਇਹਦੇ ਵਿੱਚ ਕੋਈ ਹੋਰ ਮੋਡਲ ਦੀ ਵੀ ਖੜ੍ਹੀ ਹੋਈ ਸਕਾਰਪੀਓ ਅਪਣੇ ਕੋਲ ਕੋਈ ਹੋਰ ਸਤਾਰ੍ਹਾਂ ਅਠਾਰ੍ਹਾਂ ਮੋਡਲ ਠੀਕ ਹੈ ਅਤੇ ਹੈ ਉਹਦੇ ਸਾਰਾ ਕੁਛ ਜੈਨੂਅਨ ਹੈ ਵਿੱਚ ਇੰਜਣ ਉਂਜਣ ਠੀਕ ਹੈ ਜੀ ਅਤੇ ਫਸਟ ਓਨਰ ਏ ਜੀ ਇਹ ਠੀਕ ਹੈ ਜੀ ਠੀਕ ਹੈ ਅਤੇ ਠੀਕ ਹੈ ਜੀ ਅਤੇ ਜੇ ਆਪਾਂ ਨੇ ਉਰੇ ਅਤੇ ਡਿਲੀਵਰੀ ਕਰਾਉਣੀ ਹੋਵੇ ਤੁਹਾਡੇ ਪਾ ਹੈਗਾ ਇਹਦਾ ਸਾਧਨ ਹੈਗਾ ਭੇਜਣ ਦਾ ਠੀਕ ਹੈ ਜੀ ਅਤੇ ਜੇ ਤੁਹਾਡਾ ਵਟਸਐਪ ਨੰਬਰ ਚੱਲਦਾ ਤੁਸੀਂ ਮੈਨੂੰ ਫੋਟੋਆਂ ਭੇਜ ਸਕਦੇ ਇਸ ਨੰਬਰ ਪਾ ਠੀਕ ਠੀਕ ਹੈ ਵੀਰ ਤੁਸੀਂ ਫੋਟੋਆਂ ਭੇਜ ਦਿਉ ਜੀ ਫਿਰ